ਅੱਜ ਕੱਲ੍ਹ ਲੋਕ ਬਹੁਤ ਵੱਖ ਵੱਖ ਡਾਂਸ ਸ਼ੈਲੀਆਂ ਸਿੱਖਣ ਵਿੱਚ ਰੁਚੀ ਰੱਖਦੇ ਹਨ ਹਿਪ ਹਾਪ ਇੱਕ ਸ਼ੈਲੀ ਨੌਜਵਾਨ ਵਿੱਚ ਬਹੁਤ ਪ੍ਰਸਿੱਧ ਹੈ ਜੋ ਇੰਝ ਗਤੀਵਿਧੀਆਂ ਅਤੇ ਨਵੇਂ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੀ ਹੈ ਬਾਲੀਵੁੱਡ ਡਾਸ ਬਾਲੀਵੁੱਡ ਗਾਣਿਆਂ 'ਤੇ ਨੱਚਣਾਂ ਵੀ ਲੋਕਾਂ ਵਿੱਚ ਵੱਡੀ ਪਸੰਦਗੀ ਦਾ ਵਿਸ਼ਾ ਬਣ ਗਿਆ ਹੈ ਜਿਸ ਨਾਲ ਉਹਨਾਂ ਨੂੰ ਮਜਬੂਰੀ ਅਤੇ ਮਨੋਰੰਜਨ ਦੋਨੋਂ ਮਿਲਦੇ ਹਨ ਜੰਬਾ ਇਹ ਇੱਕ ਡਾਂਸ ਫਿਟਨੈਸ ਸ਼ੈਲੀਆਂ ਹੈ ਜੋ ਸਿਹਤ ਲਈ ਲਾਭਦਾਇਕ ਹੈ ਅਤੇ ਲੋਕਾਂ ਨੂੰ ਖੁਸ਼ ਰੱਖਦੀ ਹੈ ਚਾਸ਼ਨੀ ਅਤੇ ਪ੍ਰੰਪਰਾਰੀਕ ਡਾਂਸ ਬਹੁਤ ਸਾਰੇ ਲੋਕ ਆਪਣੇ ਸੰਸਕ੍ਰਿਤਿਕ ਮੁੱਲਾਂ ਨੂੰ ਯਾਦ ਰੱਖਦਿਆਂ ਵਿਚਾਰਨ ਡਾਂਸ ਸਿੱਖਣ ਵਿੱਚ ਰੁਚੀ ਰੱਖਦੇ ਹਨ ਜਿਵੇਂ ਕਿ ਭਰਤਨਾਟਿਅਮ ਕਥਕ ਸਮਾਂ ਰੋਤਕ ਡਾਂਸ ਕਈ ਲੋਕ ਵਿਆਹ ਜਾਂ ਫੈਸ਼ਨ ਸ਼ੋਅਜ ਲਈ ਕਾਫ਼ੀ ਸਿੱਖਦੇ ਹਨ ਜੋ ਇਨਸਾਨੀ ਮਿਲਾਪ ਨੂੰ ਪ੍ਰਗਟ ਕਰਨ ਦਾ ਮਾਧਿਅਮ ਹੈ ਇਸ ਤਰ੍ਹਾਂ ਵਿਭਿੰਨ ਡਾਂਸ ਸ਼ੈਲੀਆਂ ਨਾਲ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਸੀਂ ਮਨੋਰੰਜਨ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਲੋਕਾਂ ਦੀਆਂ ਡਾਂਸ ਸਿੱਖਣ ਦੀਆਂ ਪਸੰਦਾਂ ਵਿੱਚ ਹੋਰ ਵਿਸਥਾਰ ਸਮੂਹਿਕ ਡਾਂਸ ਸਮੂਹਿਕ ਡਾਂਸ ਕਲਾਸਾਂ ਜਿਵੇਂ ਕਿ ਸਲਾਟਰ ਅਤੇ ਕਿਡਸਟੈਪ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਇਹ ਸਮਾਜਿਕ ਗਤੀਵਿਧੀਆਂ ਦਾ ਹਿੱਸਾ ਬਣੀਆਂ ਹਨ ਅਤੇ ਲੋਕਾਂ ਨੂੰ ਮਿਲਣ ਦਾ ਮੌਕਾ ਦਿੰਦੇ ਹਨ ਫਿਟਨੈਸ ਡਾਂਸ ਫਿਟਨੈਸ ਇੱਕ ਰੋਬਿਨਕਸ ਅਤੇ ਡਾਂਸ ਨਾਟੇਸ਼ ਦੀਆਂ ਕਲਾਸਾਂ ਵੀ ਪ੍ਰਸਿੱਧ ਹੋ ਰਹੀਆਂ ਹਨ ਇਹ ਸਿਹਤ ਨੂੰ ਸੁਧਾਰਨ ਦੇ ਨਾਲ ਨਾਲ ਸਰੀਰ ਨੂੰ ਫਿਟ ਰੱਖਣ ਵਿੱਚ ਮਦਦਗਾਰ ਹਨ ਡਿਜੀਟਲ ਪਲੇਟਫਾਰਮ ਯੂਟੀਊਬ ਅਤੇ ਆਨਲਾਈਨ ਕੋਰਸ ਦੇ ਜ਼ਰੀਏ ਲੋਕ ਅਕਸਰ ਪਰ ਬੈਠੇ ਵੀ ਡਾਂਸ ਸਿੱਖਦੇ ਹਨ ਇਸ ਨਾਲ ਉਹਨਾਂ ਨੂੰ ਆਸਾਨੀ ਨਾਲ ਵਿਭਿੰਨ ਸ਼ੈਲੀਆਂ ਪੜ੍ਹਣ ਦਾ ਮੌਕਾ ਮਿਲਦਾ ਹੈ